ਹੈਲੋ ਹਾਂਜੀ ਬ੍ਰਦਰ ਢਾਬੇ ਤੋਂ ਬੋਲਦੇ ਪਏ ਜੀ ਮੇਰਾ ਨਾ ਤੁਹਾਡੇ ਕੋਲ ਨਾ ਇੱਕ ਔਡਰ ਹੋਏਗਾ ਸਵਿਗੀ ਤੋਂ ਹਾਂਜੀ ਗੋਪੀਕਾ ਦੇ ਨਾਮ ਦਾ ਔਡਰ ਹੈਗਾ ਜੀ ਜਿਹਦੇ ਵਿੱਚ ਨਾ ਇੱਕ ਆਪਣਾ ਚਾਰ ਬਟਰ ਨਾਨ ਹੈਗੇ ਜੇ ਅਤੇ ਦੋ ਸ਼ਾਹੀ ਪਨੀਰ ਹੈਗੇ ਜੇ ਹਾਂਜੀ ਹਾਂਜੀ ਹਾਂਜੀ ਮੈਂ ਨਾ ਤੁਹਾਨੂੰ ਇਸ ਕਰਕੇ ਕੋਲ ਕੀਤੀ ਸੀਗੀ ਕਿ ਜਿਹੜਾ ਮੇਰਾ ਔਡਰ ਹੈਗਾ ਨਾ ਇੱਕ ਤਾਂ ਨਾ ਟਾਈਮ ਸਿਰ ਪਹੁੰਚਾ ਦਿਉ ਅਤੇ ਨੰਬਰ ਦੋ ਉਹਦੇ ਨਾਲ ਨਾ ਥੋੜ੍ਹਾ ਡਿਸਪੋਜਬਲ ਸਮਾਨ ਪੈਕ ਕਰਵਾ ਦਿਉ ਜਿਵੇਂ ਕਿ ਉਹਦੇ ਵਿੱਚ ਨਾ ਤੁਸੀਂ ਚਾਰ ਕੱਪ ਪਲੇਟਾਂ ਚਾਰ ਕੁ ਚਮਚ ਤੇ ਤਿ ਪ ਚਾਰ ਪੰਜ ਨੈਪਕਿਨ ਪਤਾ ਕਿਉਂ ਅਸੀਂ ਸਾਨੂੰ ਨਾ ਥੋੜ੍ਹਾ ਅਰਜੈਂਟ ਕਿਤੇ ਜਾਣਾ ਪੈ ਗਿਆ ਹੈ ਅਤੇ ਅਰਜੈਂਟ ਜਾਣ ਦੇ ਕਾਰਨ ਨਾ ਤਾਂ ਮੈਂ ਸੋਚ ਰਹੀ ਹਾਂ ਕਿ ਆਪਣਾ ਭੋਜਨ ਨਾ ਮੈਂ ਨਾਲ ਹੀ ਲੈ ਕੇ ਜਾਵਾਂ ਅਤੇ ਹਾਂਜੀ ਹਾਂਜੀ ਹਾਂਜੀ ਅਤੇ ਥੋੜ੍ਹਾ ਨਾ ਆਪਣਾ ਕੀ ਕਹਿੰਦੇ ਹੈ ਸਵੀਟ ਡਿਸ਼ ਉਹ ਜਿਹੜੀ ਹੁੰਦੀ ਹੈ ਨਾ ਸ਼ੌਫ ਉਹ ਵੀ ਦੋ ਕੁ ਪੈਕਟ ਪਾ ਦਿਉ ਉਹਦੇ ਵਿੱਚ ਹਾਂਜੀ ਨਾਲ ਪਿਕਲਜ ਪਾਉਣਾ ਨਾ ਭੁੱਲਿਉ ਪਿੱਕਲ ਅਤੇ ਸੈਲ ਪਿੱਕਲ ਅਤੇ ਜਿਹੜਾ ਹੁੰਦਾ ਪਿਆਜ ਸਿਰਕੇ ਵਾਲਾ ਉਹ ਵੀ ਪਵਾ ਦਿਉ ਧੰਨਵਾਦ ਜੀ